ਹੈਲੋ ਗੁਡ ਮੋਰਨਿੰਗ ਸਰ ਹਾਂਜੀ ਗੁਡ ਮੋਰਨਿੰਗ ਜੀ ਸਰ ਲਕਸ ਤੋਂ ਗੱਲ ਕਰ ਰਹੇ ਜੀ ਹਾਂਜੀ ਬੋਲੋ ਜੀ ਸਰ ਤੁਸੀਂ ਸਰ ਪ੍ਰੋਡਕਟ ਬਾਏ ਕੀਤਾ ਸੀਗਾ ਜੀ ਅਤੇ ਸਰ ਮੈਂ ਜਾਨਣਾ ਚਾਹੁੰਦਾ ਕਿ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਜੀ ਇਸ ਬਾਰੇ 'ਚ ਜੀ ਵਧੀਆ ਜੀ ਬਹੁਤ ਵਧੀਆ ਰਿਹਾ ਜੀ ਐਕਸਪੀਰੀਅੰਸ ਸਿਰਫ਼ ਉਹਨੂੰ ਯੂਜ ਕੀਤਾ ਅਤੇ ਇਹਦਾ ਰਿਜ਼ਲਟ ਬਹੁਤ ਵਧੀਆ ਆਇਆ ਜੀ ਸਰ ਕੀ ਕੀ ਸਰ ਤੁਹਾਨੂੰ ਇਹਦੇ ਵਿੱਚ ਵਧੀਆ ਲੱਗਿਆ ਜੀ ਸਰ ਇੱਕ ਤਾਂ ਇਹ ਹੈ ਕਿ ਇਹਦੇ ਵਿੱਚ ਇਹਦੀ ਖੁਸ਼ਬੂ ਬਹੁਤ ਅੱਛੀ ਹੈ ਜੀ ਔਰ ਦੂਸਰਾ ਕਾਰਣ ਇਹ ਹੈਗਾ ਕਿ ਇਹਦੇ ਵਿੱਚ ਇਹ ਜਿੱਦਾਂ ਇਹ ਫੋਰ ਮਤ ਟਿੱਕੀ ਦੇ ਪੈਕ ਵਿੱਚ ਆਉਂਦਾ ਅਤੇ ਉਹਦੇ ਨਾਲ ਇੱਕ ਟਿੱਕੀ ਫ੍ਰੀ ਹੋਵੇਗੀ ਇਹ ਸਾਰਾ ਐਕਸਟਰਾ ਇੱਕ ਟਿੱਕੀ ਮਿਲ ਜਾਂਦੀ ਹੈ ਜਦੋਂ ਕਿ ਅਦਰ ਪ੍ਰੋਡਕਟ ਵਿੱਚ ਇਹ ਅਦਰ ਸਾਬਣ ਜਦੋਂ ਆਪਾਂ ਯੂਜ ਕਰਦੇ ਹਾਂ ਉਹਦੇ ਵਿੱਚ ਇਹ ਫਿਲਟੀ ਅਵੇਲੇਬਲ ਨਹੀਂ ਹੈਗੀ ਜੀ ਔਰ ਇਹ ਬਹੁਤ ਵਧੀਆ ਸਮੈਲ ਹੈ ਔਰ ਇਹ ਝੱਗ ਵੀ ਬਹੁਤ ਜ਼ਿਆਦਾ ਬਣਾਉਂਦਾ ਹੈ ਔਰ ਖੁਰਦਾ ਵੀ ਘੱਟ ਹੈ ਹਾਂਜੀ ਸਰ ਜੀ ਜੀ ਔਰ ਸਰ ਕੋਈ ਇਹਦਾ ਕਾਰਣ ਸਰ ਕਾਰਣ ਤਾਂ ਇਹ ਹੀ ਹੈ ਜੀ ਜੀ ਕਿ ਲੁਕ ਵਾਈਸ ਵੀ ਬਹੁਤ ਵਧੀਆ ਹੈ ਅਤੇ ਇਹ ਪਿੰਕ ਕਲਰ ਵਿੱਚ ਆਉਂਦਾ ਜੋ ਕਿ ਬਹੁਤ ਹੀ ਵਧੀਆ ਫਰੈਗਰੈਂਸ ਦੇ ਰਿਹਾ ਜੀ ਠੀਕ ਹੈ ਸਰ ਠੀਕ ਹੈ ਸਰ ਲਕਸ ਸਾਬਣ ਖਰੀਦਣ ਲਈ ਤੁਹਾਡਾ ਧੰਨਵਾਦ ਅਸੀਂ ਆਸ਼ਾ ਕਰਦੇ ਹਾਂ ਕਿ ਅੱਗੇ ਵੀ ਤੁਸੀਂ ਇਸ ਨੂੰ ਖਰੀਦਦੇ ਰਹੋਗੇ ਜੀ ਸਰ ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ ਜੀ